ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਕੌਣ ਹਾਂਜੀ ਹਾਂਜੀ ਭੈਣ ਜੀ ਤੁਸੀਂ ਕੌਣ ਅੱਛਾ ਅੱਛਾ ਹਾਂਜੀ ਭੈਣ ਜੀ ਕੀ ਹਾਲ ਨੇ ਹਾਂਜੀ ਹਾਂਜੀ ਕਦੋਂ ਆਏ ਭੈਣ ਜੀ ਅੱਛਾ ਜੀ ਚਲੋ ਵਧੀਆ ਹਾਂਜੀ ਭੈਣ ਜੀ ਅੱਛਾ ਜੀ ਹਾਂਜੀ ਅਤੇ ਮੈਂ ਤੁਹਾਡੀ ਕੀ ਹੈਲਪ ਕਰ ਸਕਦੀ ਆ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਭੈਣ ਜੀ ਇੱਕ ਤਾਂ ਵੈਸੇ ਤਾਂ ਬਹੁਤ ਸਾਰੇ ਗੁਰਦੁਆਰੇ ਨੇ ਨਵਾ ਸ਼ਹਿਰ 'ਚ ਅਤੇ ਜਿਹੜੇ ਮਤਲਬ ਫ਼ੇਮਸ ਨੇ ਸਭ ਤੋਂ ਜ਼ਿਆਦਾ ਵਧੀਆ ਨੇ ਅਤੇ ਗੁਰਦੁਆਰੇ ਤਾਂ ਚਲੋ ਵਧੀਆ ਹੀ ਹੁੰਦੇ ਨੇ ਮਤਲਬ ਜਿੱਥੇ ਜਿੱਥੇ ਜ਼ਿਆਦਾ ਜਾਂਦੇ ਨੇ ਲੋਕੀ ਇੱਕ ਤਾਂ ਟਿੱਬੀ ਸਾਹਿਬ ਗੁਰਦੁਆਰਾ ਸਾਹਿਬ ਹੈ ਨਾਂ ਅਤੇ ਇੱਕ ਰਾਹ ਇਹ ਰੋਪੜ ਰੋਡ 'ਤੇ ਪੈ ਜਾਂਦੇ ਹੈ ਭੈਣ ਜੀ ਹਾਂਜੀ ਇੱਕ ਹੋ ਗਿਆ ਰਾਜਾ ਸਾਹਿਬ ਗੁਰਦੁਆਰਾ ਅਤੇ ਇੱਕ ਇੱਕ ਇਹ ਰਾਹੋਂ ਰੋਡ 'ਤੇ ਹੈ ਜੀ ਬੰਗਿਆ ਸਾਈਡ ਹਾਂਜੀ ਹਾਂਜੀ ਅਤੇ ਇੱਕ ਕਰਪਾਲ ਸਾਗਰ ਹੈ ਉਹ ਵੀ ਰਾਹੋਂ ਰੋਡ 'ਤੇ ਹੀ ਹੈ ਅਤੇ ਇੱਕ ਟਾਹਲੀ ਸਾਹਿਬ ਗੁਰਦੁਆਰਾ ਹੈ ਅਤੇ ਹੋਰ ਵੀ ਬਹੁਤ ਸਾਰੇ ਗੁਰਦੁਆਰਾ ਨੇ ਗੁਰਦੁਆਰਾ ਨੇ ਜੇ ਤੁਸੀਂ ਜਾਣਾ ਚਾਹੋਂ ਅਤੇ ਤੁਸੀਂ ਜਾਂ ਸਕਦੇ ਹੋ ਵਧੀਆ ਜਗ੍ਹਾਂ ਨੇ ਘੁੰਮਣ ਵਾਲੀਆ ਬਹੁਤ ਮ ਮਜ਼ਾ ਆਊਗਾ ਬੱਚਿਆਂ ਵਿੱਚ ਤੁਸੀਂ ਬਹੁਤ ਇੰਨਜੋਏ ਕਰੋਗੇ ਅਤੇ ਇਹ ਜੇ ਤੁਹਾਨੂੰ ਨਹੀਂ ਪਤਾ ਲੱਗਿਆ ਤਾਂ ਮੈਂ ਆਪਣਾ ਕੋਈ ਬੱਚਾ ਤੁਹਾਡੇ ਨਾਲ਼ ਭੇਜ਼ ਦੇਵਾਂਗੀ ਭੈਣ ਜੀ ਹਾਂਜੀ ਹਾਂਜੀ ਹਾਂ ਹਾਂ ਹਾਂ ਮੈਨੂੰ ਦੱਸ ਦਿਓ ਮੈਂ ਤੁਹਡੇ ਨਾਲ਼ ਕੋਈ ਨਾ ਕੋਈ ਭੇਜ ਦੇਵਾਂਗੀ ਠੀਕ ਹੈ ਜੀ ਠੀਕ ਹੈ ਭੈਣ ਜੀ